ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਕਰਮਵੀਰ ਬੋਲਣ ਡਿਆ ਸਰ ਅਸੀਂ ਤੁਹਾਡੇ ਕੋਲੋਂ ਕਾਰ ਬੁੱਕ ਕਰਵਾਈ ਸੀ ਅਤੇ ਅਸੀਂ ਨਾ ਮਲ ਕਿ ਉਹਦੀ ਪੇਮੈਂਟ ਵੀ ਤੁਹਾਨੂੰ ਪਹਿਲਾਂ ਕਰ ਚੁੱਕੇ ਹਾਂ ਅਤੇ ਤੁਹਾਡਾ ਕਾਰ ਵਾਲਾ ਸਾਡੇ ਘਰ ਅਜੇ ਤੱਕ ਨਹੀਂ ਪਹੁੰਚਿਆ ਅਸੀਂ ਇੱਥੋਂ ਜਲੰਧਰ ਜਾਣਾ ਸੀ ਜਿਸ ਵਿੱਚ ਸਾਨੂੰ ਜਾਣ 'ਚ ਦੋ ਘੰਟੇ ਲੱਗ ਜਾਂਦੇ ਆ ਅਤੇ ਦੋ ਘੰਟੇ ਲੱਗ ਜਾਂਦੇ ਅਤੇ ਪਰ ਦੋ ਘੰਟੇ ਤਾਂ ਇੱਥੇ ਤੁਹਾਡਾ ਡਰਾਈਵਰ ਲੇਟ ਹੋ ਗਿਆ ਅਤੇ ਅਸੀਂ ਕਿਹੜੇ ਟਾਈਮ ਉੱਥੇ ਦੱਸੋ ਪਹੁੰਚਾਂਗੇ ਇਸ ਕਰਕੇ ਅਤੇ ਮਲ ਕਿ ਸਾਡੀ ਰਿਕੁਐਸਟ ਆ ਵੀ ਜੋ ਅਸੀਂ ਤੁਹਾਨੂੰ ਪੈਸੇ ਤੁਹਾਨੂੰ ਦਿੱਤੇ ਆ ਹਾਂਜੀ ਉਹ ਸਾਡੇ ਤੁਸੀਂ ਵਾਪਸ ਕਰ ਦਿਓ ਅਤੇ ਬਾਕੀ ਇਹ ਵੀ ਸਾਡੇ ਇੱਥੇ ਨਜ਼ਦੀਕੀ ਅਸੀਂ ਹੋਰ ਕਿਸੇ ਨਾਲ ਗੱਲ ਕੀਤੀ ਆ ਅਤੇ ਉਹਨਾਂ ਨੂੰ ਅਸੀਂ ਆਖਿਆ ਵੀ ਤੁਸੀਂ ਗੱਡੀ ਸਾਡੇ ਕੋਲ ਭੇਜ ਦਿਓ ਅਤੇ ਉਹ ਗੱਡੀ ਸਾਡੀ ਸਾਡੇ ਕੋਲ ਆ ਚੱਲੀ ਆ ਅਤੇ ਅਸੀਂ ਉਹ 'ਤੇ ਚਲੇ ਜਾਵਾਂਗੇ ਅਤੇ ਮਿਹਰਬਾਨੀ ਕਰਕੇ ਜਿਹੜੀ ਸਾਡੀ ਪੇਮੈਂਟ ਆ ਨਾ ਉਹ ਤੁਸੀਂ ਸਾਡੇ ਇਸੇ ਜਿਹੜੇ ਅਕਾਊਂਟ 'ਚ ਮੈਂ ਤੁਹਾਨੂੰ ਪੇ ਕੀਤੀ ਸੀ ਨਾ ਪੇਮੈਂਟ ਉਸੇ ਅਕਾਊਂਟ 'ਚ ਤੁਸੀਂ ਸਾਡੀ ਉਸੇ ਪੇਮੈਂਟ ਜਿਹੜੀ ਆ ਸਾਡੇ ਅਕਾਊਂਟ ਦੇ ਵਿੱਚ ਵਾਪਸ ਪਾ ਦਿੱਤੀ ਜਾਵੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਊਗਾ ਜੀ